ਸ਼੍ਰੀ ਪਟਨਾ ਸਾਹਿਬ ਦੀ ਯਾਤਰਾ ਦੌਰਾਨ ਮੈਂ ਰੇਲ ਗੱਡੀ ਦੇ ਵਿੱਚ ਕਈ ਅਜਿਹੇ ਸਿੱਖ ਨੌਜਵਾਨ ਵੇਖੇ ਜੋ ਕਿ ਜਰਦੇ ਅਤੇ ਕੁਝ ਹੋਰ ਨਸ਼ੇ ਕਰ ਰਹੇ ਸਨ ਇਹ ਸਿੱਖੀ ਸਿਧਾਂਤ ਦੇ ਬਿਲਕੁਲ ਉਲਟ ਹੈ ਅਤੇ ਪੰਜਾਬ ਦਾ ਇਹ ਸੱਭਿਆਚਾਰ ਨਹੀਂ ਹੈ ਇਸ ਲਈ ਉਹਨਾਂ ਨੂੰ ਸਮਝਾਉਣ ਲਈ ਸੋਚਿਆ ਗਿਆ ਅਤੇ ਉਹਨਾਂ ਨੂੰ ਸਮਝਾਇਆ ਗਿਆ ਕਿ ਉਹ ਇਸ ਪੰਜਾਬ ਦੇ ਸੱਭਿਆਚਾਰ ਨੂੰ ਸਮੋਅ ਕੇ ਰੱਖਣ ਠੀਕ ਰੱਖਣ ਅਤੇ ਅਜਿਹੇ ਨਸ਼ੇ ਪੱਤੇ ਆਪ ਦੂਰ ਰਹਿਣ ਅਤੇ ਹੋਰਾਂ ਨੂੰ ਵੀ ਇਹਨਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਤਾਂ ਜੋ ਪਰਿਵਾਰ ਹਨ ਉਹ ਸੁਖੀ ਵੱਸਣ ਅਤੇ ਕਿਸੇ ਕਿਸਮ ਦੀ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ ਅਤੇ ਆਪਣੇ ਸਰੀਰ ਦਾ ਵੀ ਉਹ ਧਿਆਨ ਰੱਖ ਸਕਦੇ ਹਨ ਅਤੇ ਨਸ਼ੇ ਪੱਤਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ